ਵਿਰਾਟ ਕੋਹਲੀ ਰੋਹਿਤ ਸ਼ਰਮਾ ਐਸ਼ਵਰਿਆ ਰਾਏ ਦੀਪਿਕਾ ਪਾਦੂਕੋਨ ਪ੍ਰਿਅੰਕਾ ਚੋਪੜਾ ਆਲੀਆ ਭੱਟ ਰਣਵੀਰ ਕਪੂਰ ਰਣਵੀਰ ਸਿੰਘ ਅੰਬਾਨੀ ਰਤਨ ਅੰਬਾਨੀ ਐਬਾ ਐਮੀ ਵਿਰਕ